ਸਤਿ ਸ਼੍ਰੀ ਅਕਾਲ ਸਰ ਮੇਰਾ ਨਾਂ ਸੁਰਿੰਦਰ ਕੁਮਾਰ ਹੈ ਮੈਂ ਦੀਨਾ ਨਗਰ ਦਾ ਰਹਿਣ ਵਾਲਾ ਪਿੱਛੇ ਸੀਜ਼ਨ 'ਚ ਗਰਮੀ ਜ਼ਿਆਦਾ ਹੋਣ ਕਰਕੇ ਮੇਰਾ ਪੱਖਾ ਖਰਾਬ ਹੋਈ ਗਿਆ ਅਤੇ ਮੈਂ ਗੁਰਦਾਸਪੁਰ ਤੋਂ ਪੱਖਾ ਮੰਗਵਾਇਆ ਸੀ ਉਹ ਪੱਖਾ ਹੇਵਲ ਕੰਪਨੀ ਦਾ ਸੀ ਬਹੁਤ ਵਧੀਆ ਪੱਖਾ ਸੀ ਉਹ ਉਹ ਫਿੱਟ ਕੀਤਾ ਬੜਾ ਵਧੀਆ ਚੱਲ ਰਿਹਾ ਪੰਜਾਹ ਵਾਟ ਦਾ ਪੱਖਾ ਸੀ ਅਤੇ ਬਹੁਤ ਸੋਹਣਾ ਚੱਲ ਰਿਹਾ ਉਹਦਾ ਕਲਰ ਵੀ ਵਧੀਆ ਉਹਦੇ ਪੰਖ ਵੀ ਵਧੀਆ ਅਤੇ ਸਾਨੂੰ ਬਿਲਕੁਲ ਸਹੀ ਰੇਟ 'ਤੇ ਵੀ ਮਿਲ ਗਿਆ ਔਨਲਾਈਨ ਸਿਸਟਮ ਬੜਾ ਵਧੀਆ ਲੱਗਾ ਔਨਲਾਈਨ ਪੱਖਾ ਆ ਗਿਆ ਸੀ ਘਰ ਮਿਸਤਰੀ ਬੁਲਾ ਕੇ ਫਿੱਟ ਕਰਵਾ ਲਿਆ ਅਤੇ ਠੀਕ ਚੱਲ ਰਿਹਾ ਜੀ ਕੰਮ ਅਤੇ ਪੱਖਾ ਵਧੀਆ ਚੱਲ ਰਿਹਾ ਅਤੇ ਮੈਂ ਹੋਰ ਵੀ ਮੰਗਵਾਉਣਾ ਚਾਹੁੰਦਾ ਪੱਖਾ ਪਰ ਹੁਣ ਚਲੋ ਦੇਖੋ ਅਤੇ ਬਾਕੀ ਸਭ ਠੀਕ ਹੈ